ਮੇਰੇ ਪਿਤਾ ਦੀ ਇਨਕਮ ਘੱਟ ਹੋਣ ਦੇ ਕਾਰਨ ਮੈਂ ਆਪਣੇ ਪਰਿਵਾਰ ਅਤੇ ਦੋਸਤਾਂ ਦੇ ਨਾਲ ਪਿਕਨਿਕ 'ਤੇ ਗੁਰੂ ਘਰ ਹੀ ਜਾਂਦੀ ਹਾਂ ਕਿਉਂਕਿ ਗੁਰੂ ਘਰ ਜਾ ਕੇ ਮੈਨੂੰ ਸਕੂਨ ਮਿਲਦਾ ਹੈ ਗੁਰੂ ਘਰ ਜਾ ਕੇ ਮੈਂ ਸੇਵਾ ਵੀ ਕਰਦੀ ਹਾਂ ਜਿਵੇਂ ਕਿ ਬਰਤਨਾਂ ਦੀ ਸੇਵਾ ਗੁਰੂ ਘਰ ਦੀ ਸਾਫ਼ ਸਫ਼ਾਈ ਲੰਗਰ ਲੰਗਰ ਵਰਤਾਉਣਾ ਦੀ ਸੇਵਾ ਕਰਦੀ ਹਾਂ ਜਦੋਂ ਮੈਂ ਗੁਰੂ ਘਰ ਜਾ ਕੇ ਗੁਰਬਾਣੀ ਸੁਣਦੀ ਹਾਂ ਤਾਂ ਮੈਨੂੰ ਚੈਨ ਮਿਲਦਾ ਹੈ ਗੁਰੂ ਘਰ ਵਿੱਚ ਹਰ ਹਰ ਸੰਗਤ ਆਪਣੇ ਦੁੱਖ ਦੁੱਖ ਲੈ ਕੇ ਆਉਂਦੀ ਹੈ ਕੋਈ ਆਪਣੀ ਸ਼ਰਧਾ ਦੇ ਪੂਰਵਕ ਕਿਸੇ ਦੀ ਮਨੋਕਾਮਨਾ ਪੂਰੀ ਹੁੰਦੀ ਹੈ ਤਾਂ ਉਹ ਗੁਰੂ ਘਰ ਆ ਕੇ ਨਮਸਤਕ ਹੁੰਦਾ ਹੈ ਕੋਈ ਆਪਣੇ ਦੁੱਖ ਦੂਰ ਕਰਨ ਲਈ ਆਉਂਦਾ ਹੈ ਕਿਉਂਕਿ ਕਈ ਗੁਰਦੁਆਰਿਆਂ ਦੀ ਇਤਿਹਾਸਿਕਤਾ ਹੁੰਦੀ ਹੈ ਕਿ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਦੁੱਖ ਦੂਰ ਹੋ ਜਾਂਦੇ ਹਨ ਤਾਂ ਕਰਕੇ ਸੰਗਤ ਆਪਣੇ ਦੁੱਖ ਦੂਰ ਕਰਨ ਲਈ ਗੁਰੂ ਘਰ ਆਉਂਦੀ ਹੈ